ਹੈਲੋ ਹੈਲੋ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਛੱਡ ਕੇ ਜਾਣੀ ਪਏਗੀ ਸਾਡੀ ਦੁਕਾਨ 'ਤੇ ਦੇਖ ਕੇ ਹੀ ਪਤਾ ਚੱਲੇਗਾ ਕੰਪਰੈਸ਼ਰ ਵਿੱਚ ਦਿਕੱਤ ਕੀ ਏ ਅੱਛਾ ਜੀ ਚਲੋ ਫਿਰ ਅਸੀਂ ਅੱਧੇ ਘੰਟੇ ਤੱਕ ਪਹੁੰਚ ਜਾਂਦੇ ਹਾਂ ਕਾਰ ਨੂੰ ਉੱਥੇ ਲੈ ਜਾਓਗੇ ਦੇਖਾਂਗੇ ਪਰ ਇਹ ਚਾਰ ਪੰਜ ਘੰਟੇ ਦਾ ਟਾਈਮ ਲੱਗੇਗਾ ਕਾਰ ਨੂੰ ਦੇਖਣ 'ਚ ਰਿਪੇਅਰਿੰਗ ਕਰਨ ਵਿੱਚ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਬੇਫਿਕਰ ਬੇਫਿਕਰ ਰਹੋ ਤੁਸੀਂ ਤੁਹਾਨੂੰ ਕੰਪਰੈਸ਼ਰ 'ਚ ਦਿਕੱਤ ਲੱਗਦੀ ਹੈ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਏਸੀ ਨਹੀਂ ਚੱਲ ਰਿਹਾ ਹਾਂਜੀ ਉਹ ਤਾਂ ਫਿਰ ਦੇਖਿਆ ਹੀ ਸਾਰਾ ਪਤਾ ਚੱਲੇਗਾ ਵੀ ਕਿੱਥੇ ਦਿੱਕਤ ਆ ਰਹੀ ਹੈ ਹਾਂਜੀ ਹਾਂਜੀ ਸਾਡੇ ਕੋਲ ਸਾਰੀ ਵਰਕਸ਼ਾਪ ਹੈ ਠੀਕ ਹੈ ਜੀ ਠੀਕ ਹੈ ਜੀ ਅਸੀਂ ਅੱਧੇ ਘੰਟੇ 'ਚ ਮੈਂ ਭੇਜ ਦਿੰਦੇ ਆਪਦੇ ਵਰਕਰ ਨੂੰ ਉਹ ਤੁਹਾਡੇ ਕੋਲ ਲੈ ਜਾਂਦੇ ਨੇ ਤੁਸੀਂ ਕਾਰ ਦੀ ਚਾਬੀ ਦੇ ਦਿਓ ਜੇ ਠੀਕ ਹੈ ਜੀ ਧੰਨਵਾਦ